ਸਾਡੇ ਸਮਾਜ ਵਿੱਚ ਬਹੁਤ ਹੀ ਸਾਰੇ ਜਾਨਵਰਾਂ ਨੂੰ ਪਾਲਿਆ ਪੋਸਿਆ ਜਾਂਦਾ ਹੈ ਅਤੇ ਮੈਂ ਖੁਦ ਵੀ ਕੁੱਤਾ ਪਾਲਿਆ ਹੋਇਆ ਹੈ ਅਤੇ ਬਹੁਤ ਹੀ ਸਾਊ ਹੈ ਅਤੇ ਅਤੇ ਬਹੁਤ ਹੀ ਵਫ਼ਾਦਾਰ ਹੈ ਉਸਨੂੰ ਮੈਂ ਕਿਸੇ ਵਧੀਆ ਟ੍ਰੇਨਰ ਤੋਂ ਟ੍ਰੇਨਿੰਗ ਦਵਾਈ ਹੋਈ ਹੈ ਬਹੁਤ ਹੀ ਗੱਲਾਂ ਨੂੰ ਸਮਝਦਾ ਹੈ ਅਤੇ ਮੇਰੀ ਹਰ ਗੱਲ ਨੂੰ ਸਮਝਦਾ ਹੈ ਅਤੇ ਬਹੁਤ ਹੀ ਵਫ਼ਾਦਾਰ ਹੈ